ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ ਇਸ ਨੇ ਸਾਨੂੰ ਆਪਣੇ ਪੰਜਾਬ ਵਿੱਚ ਹੀ ਨਹੀਂ ਦੇਸਾਂ ਵਿਦੇਸਾਂ ਵਿੱਚ ਵੀ ਪਹਿਚਾਣ ਦਵਾਈ ਅਤੇ ਇੱਥੇ ਦੇ ਸੱਭਿਆਚਾਰ ਨੇ ਜਿਵੇਂ ਕਿ ਭੰਗੜਾ ਗਿੱਧਾ ਇਸ ਨੇ ਵੀ ਸਾਡੇ ਪੂਰੇ ਪੰਜਾਬੀ ਸੱਭਿਆਚਾਰ ਨੂੰ ਪ੍ਰਭਾਵਿਤ ਕੀਤਾ ਅਤੇ ਪੰਜਾਬ ਦੀ ਪੰਜਾਬੀ ਦੀ ਪਛਾਣ ਨਾਲ਼ ਹੀ ਪੂਰੇ ਹਿੰਦੁਸਤਾਨ ਨੇ ਨਹੀਂ ਪੂਰੇ ਦੁਨੀਆਂ ਵਿੱਚ ਹੀ ਪੰਜਾਬੀਆਂ ਦੀ ਪਹਿਚਾਣ ਹੈ ਅਤੇ ਪੰਜਾਬੀਆਂ ਦੀ ਸ਼ਾਨ ਵੱਖਰੀ ਹੈ ਅਤੇ ਪੂਰੇ ਪੰਜਾਬੀਆਂ ਲਈ ਇਸ ਗੱਲ ਦਾ ਮਾਣ ਹੈ ਅਤੇ ਪੂਰੇ ਦੁਨੀਆਂ ਵਿੱਚ ਲੋਕ ਪੰਜਾਬੀਆਂ 'ਤੇ ਮਾਣ ਮਹਿਸੂਸ ਕਰਦੇ ਹਨ ਅਤੇ ਪੰਜਾਬੀਆਂ 'ਤੇ ਵਿਸ਼ਵਾਸ ਪੂਰਾ ਬਣਾ ਕੇ ਰੱਖਦੇ ਹਨ